ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੇਰੀ ਗੱਲ ਨਵੱਲਟੀ ਵਾਲਿਆਂ ਨਾਲ ਹੋ ਰਹੀ ਆ ਹਾਂਜੀ ਹਾਂਜੀ ਸਰ ਸਰ ਮੈਂ ਨਾ ਐਕਚੁਲੀ ਇੱਕ ਪਾਰਟੀ ਔਰਗਨਾਇਸ ਕੀਤੀ ਸੀਗੀ ਮੇਰਾ ਐਕਚੁਲੀ ਫਰੈਂਡ ਦਾ ਬਰਡੇ ਹੈ ਅਤੇ ਉਦ ਉਹਨੂੰ ਮੈਂ ਸਰਪ੍ਰਾਈਸ ਪਾਰਟੀ ਦੇਣੀ ਹੈ ਜਿਹਦੇ ਸਰ ਮੈਂ ਕਾਫ਼ੀ ਕੁਛ ਔਡਰ ਕਰਨਾ ਚਾਹੁੰਦਾ ਅਤੇ ਮੈਂ ਤੁਹਾਡੇ ਰੈਸਟੋਰੈਂਟ ਦਾ ਨਾ ਰਿਵੀਊ ਦੇਖਿਆ ਸੀਗਾ ਕਾਫ਼ੀ ਅੱਛਾ ਆ ਨਾਲੇ ਕਾਫ਼ੀ ਵਧੀਆ ਰੀਵੀਊ ਹੈਗਾ ਨਾ ਤੁਹਾਡੇ ਰੈਸਟੋਰੈਂਟ ਦੇ ਅਤੇ ਮੈਂ ਸਰ ਉਹਦੇ ਵਿੱਚ ਕੁਛ ਲਿਸਟ ਬਣਾਈ ਹੈ ਆਪਣੇ ਕੋਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰ ਜੇ ਮੈਂ ਮਤਲਬ ਸੋਚ ਰਿਹਾ ਜੇ ਮੈਂ ਤੁਹਾਨੂੰ ਦੱਸਾਂ ਤਾਂ ਭੁੱਲ ਨਾ ਜਾਓ ਜਾਂ ਮੇਰਾ ਔਡਰ ਮਿਸ ਨਾ ਹੋਜੇ ਤਾਂ ਸਰ ਤੁਸੀਂ ਕਿਸੇ ਔਨਲਾਈਨ ਐਪਲੀਕੇਸ਼ਨ 'ਤੇ ਅਵੇਲੇਬਲ ਹੈਗੇ ਹੋ ਜਿਹੜਾ ਸਾਨੂੰ ਹੋਮ ਡਿਲੀਵਰੀ ਵੀ ਪ੍ਰੋਵਾਈਡ ਕਰਦੇ ਅਤੇ ਆਪਾਂ ਸਾਰਾ ਆਪਣਾ ਔਡਰ ਜਿਹੜਾ ਉੱਥੇ ਪਾ ਦੀਏ ਹਾਂਜੀ ਹਾਂਜੀ ਸਰ ਸਵੀਗੀ ਹਾਂਜੀ ਹਾਂਜੀ ਸਰ ਸਵੀਗੀ ਸਵੀਗੀ ਹਾਂਜੀ ਸਰ ਸੁਣਿਆ ਆ ਸਰ ਇਹਦੇ ਬਾਰੇ ਠੀਕ ਹੈ ਸਰ ਮੈਂ ਨਾ ਸਰ ਸਵੀਗੀ ਦਾ ਔਡਰ ਕਰ ਦਿੰਦਾ ਸਰ ਪ੍ਰੋਪਰ ਸਰ ਡਿਲੀਵਰੀ ਮੈਨੂੰ ਕਿੰਨੀ ਦੇਰ ਤੱਕ ਪਹੁੰਚ ਜਾਵੇਗੀ ਠੀਕ ਹੈ ਸਰ ਅੱਧੇ ਘੰਟੇ ਤੱਕ ਸਰ ਆ ਜਾਵੇਗੀ ਠੀਕ ਹੈ ਸਰ ਸਰ ਕੋਈ ਸਰ ਗ਼ਲਤੀ ਨਾ ਹੋਵੇ ਸਰ ਵੇਖਿਉ ਥੋੜ੍ਹਾ ਹੈ ਨਾ ਸਰ ਕਿਉਂਕਿ ਕਾਫ਼ੀ ਗੈਸਟ ਆਏ ਹੋਣੇ ਨੇ ਅਤੇ ਕੋਈ ਦਿੱਕਤ ਹੋਏਗੀ ਤਾਂ ਸਰ ਸਾਨੂੰ ਹੀ ਬੜਾ ਕੁਝ ਫੇਰ ਫੇਸ ਕਰਨਾ ਪਵੇਗਾ ਅਤੇ ਥੋੜ੍ਹਾ ਫੇਰ ਤੁਹਾਡੇ ਰੈਸਟੋਰੈਂਟ 'ਤੇ ਵੀ ਗੱਲ ਆਏਗੀ ਅਤੇ ਟਰਾਏ ਕਰਿਓ ਸਰ ਵਧੀਆ ਤੋਂ ਵਧੀਆ ਕੁਆਲਟੀ ਫੂਡ ਸਾਨੂੰ ਅਵੇਲੇਬਲ ਕਰਿਓ ਠੀਕ ਹੈ ਹਾਂਜੀ ਸਰ ਹਾਂਜੀ ਟਾਇਮ ਸਿਰ ਸਰ ਭੇਜ ਦਿਓ ਸਰ ਕੋਈ ਐਕਸਟਰਾ ਪੇ ਤਾਂ ਨਹੀਂ ਕਰਨਾ ਪਊ ਠੀਕ ਹੈ ਠੀਕ ਹੈ ਸਰ ਧੰਨਵਾਦ ਸਰ ਧੰਨ ਬਹੁਤ ਬਹੁਤ ਧੰਨਵਾਦ ਸਰ